ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਮੈਮ ਬਸ ਵਧੀਆ ਹੋਰ ਹੋਗੀ ਤਿਆਰੀ ਮੈਮ ਪੰਦਰਾਂ ਅਗਸਤ ਦੀ ਹਾਂਜੀ ਮੈਮ ਮੈਂ ਉਨ੍ਹਾਂ ਨੇ ਫੈਂਸੀ ਡਰੈੱਸ ਕੰਪੀਟੀਸ਼ਨ ਹੋਣਾ ਏ ਛੋਟੇ ਬੱਚਿਆਂ ਦਾ ਉਨ੍ਹਾਂ ਨੇ ਭਗਤ ਸਿੰਘ ਸੁਖਦੇਵ ਮਹਾਤਮਾ ਗਾਂਧੀ ਵਗੈਰਾ ਬਣ ਕੇ ਆਉਣਾ ਏ ਤੁਹਾਡੇ ਬੱਚਿਆਂ ਨੇ ਮੈਮ ਕੀ ਕਰਨਾ ਹੈ

ਦੇਸ਼ ਭਗਤੀ ਗੀਤ ਕਿਹੜਾ ਗੀਤ ਹੈ ਅੱਛਾ ਜੀ ਅੱਛਾ ਅੱਛਾ ਹੋਗੀ ਤਿਆਰੀ ਮੈਮ ਬੱਚਿਆਂ ਦਾ ਡਾਂਸ ਸਿਖਾਤਾ ਤੁਸੀਂ ਠੀਕ ਹੈ ਜੀ ਤੇ ਮੈਮ ਕੀ ਟਾਈਮਿੰਗ ਹੈ ਕਿੰਨੇ ਵਜੇ ਤੋਂ ਸਟਾਰਟ ਹੈ ਪ੍ਰੋਗਰਾਮ ਸਕੂਲ ਵਿੱਚ ਅੱਛਾ ਜੀ ਓਕੇ ਜੀ ਹਾਂਜੀ ਠੀਕ ਹੈ ਜੀ ਓਕੇ ਠੀਕ ਹੈ ਜੀ ਠੀਕ ਹੈ ਜੀ ਅਤੇ ਮੈਮ ਅਗਲੇ ਦਿਨ ਦੀ ਛੁੱਟੀ ਹੋਏਗੀ ਸਰਕਾਰੀ ਸਕੂਲ ਦੀ ਛੁੱਟੀ ਸਕੂਲ ਵੱਲੋਂ ਹਾਂਜੀ ਹਾਂ ਸਹੀ ਗੱਲ ਆ ਮੈ ਠੀਕ ਹੈ ਮੈਮ ਠੀਕ ਹੈ ਮੈਮ ਫਿਰ ਮਿਲਦੇ ਹਾਂ ਹੈਲੋ